ਮੈਂ ਮਮਤਾ ਦੇਵੀ ਵਾਸੀ ਮਾਧੋਪੁਰ ਜ਼ਿਲ੍ਹਾ ਪਠਾਨਕੋਟ ਦੀ ਰਹਿਣ ਵਾਲੀ ਹਾਂ ਮੈਂ ਦੱਸਣਾ ਚਾਹੁੰਦੀ ਹਾਂ ਕਿ ਸਾਡੇ ਸਮਾਜ ਵਿੱਚ ਕੁਝ ਕਲਾਕ੍ਰਿਤੀਆਂ ਅਜਿਹੀਆਂ ਹਨ ਸ਼ਿਲਪਕਲਾ ਅਜਿਹੀਆਂ ਹਨ ਕਿ ਜਿਹਨਾਂ ਦੀ ਗੱਲ ਕਰੀਏ ਤਾਂ ਪਤਾ ਲੱਗਦਾ ਹੈ ਕਿ ਪੁਰਾਣੇ ਸਮੇਂ ਵਿੱਚ ਲੋਕ ਘਰਾਂ ਵਿੱਚ ਕੁੜੀਆਂ ਆਪਣੇ ਦਹੇਜ ਦੇ ਸੈਟ ਕਢਾਈ ਕਰਦੀਆਂ ਸਨ ਕੁੜੀਆਂ ਜਾਂ ਜੁਲਾਹੇ ਕੱਪੜੇ ਲੈ ਕੇ ਪੁਰਾਣੇ ਕੱਪੜੇ ਦੀਆਂ ਦਰੀਆਂ ਬੁਣਦੀਆਂ ਸਨ ਉਹਨਾਂ ਦੀਆਂ ਦਰੀਆਂ ਬੁਣਦੇ ਸਨ ਜਾਂ ਚਾਦਰਾਂ ਦੀ ਕਢਾਈ ਕੀਤੀ ਜਾਂਦੀ ਸੀ ਕਰੋਸ਼ੀਏ 'ਤੇ ਇਨ ਬਿਨ ਕਈ ਤਰ੍ਹਾਂ ਦੀਆਂ ਕਈ ਤਰ੍ਹਾਂ ਦੇ ਡਿਜ਼ਾਇਨ ਕੱਢੇ ਜਾਂਦੇ ਸਨ ਜੇਕਰ ਅਸੀਂ ਪੁਰਾਣੇ ਰੀਤੀ ਰਿਵਾਜ਼ਾਂ ਦੀ ਗੱਲ ਕਰੀਏ ਜਾਂ ਪੁਰਾਣੇ ਸੱਭਿਆਚਾਰ ਦੀ ਗੱਲ ਕਰੀਏ ਤਾਂ ਸਾਡੇ ਸੱਭਿਆਚਾਰ ਵਿੱਚ ਬੜੀਆਂ ਹੀ ਅਜਿਹੀਆਂ ਕਲਾਕ੍ਰਿਤੀਆਂ ਹਨ ਜੋ ਕਿ ਸਾਡੇ ਦਿਲ ਨੂੰ ਮੋਹ ਲੈਂਦੀਆਂ ਹਨ ਜਿਵੇਂ ਕਿ ਕੁੜੀਆਂ ਚਾਦਰਾਂ 'ਤੇ ਮੋਰ ਘੁੱਗੀਆਂ ਆਦਿ ਚੀਜ਼ਾਂ ਨੂੰ ਬਣਾਉਣਾ ਜਾਂ ਪੇੜ ਦੇ ਨਾਲ ਇਹਨਾਂ ਚੀਜ਼ਾਂ ਦੀ ਕਲਾਕਾਰੀ ਕਰਨੀ ਇਹ ਵੀ ਇੱਕ ਸਾਡੇ ਸੱਭਿਆਚਾਰ ਦਾ ਅੰਗ ਸੀ ਪਰ ਅੱਜ ਇਹਨਾਂ ਦਾ ਯੁੱਗ ਬਦਲ ਗਿਆ ਹੈ ਸਾਡੇ ਸਮਾਜ ਵਿੱਚ ਇਹ ਗੱਲਾਂ ਸਾਰੀਆਂ ਹੀ ਖਤਮ ਹੋ ਚੁੱਕੀਆਂ ਹਨ ਅੱਜ ਕਲਯੁਗ ਅੱਜ ਕੱਲ੍ਹ ਮਸ਼ੀਨਰੀ ਦਾ ਯੁੱਗ ਹੋਣ ਕਰਕੇ ਉਹਨਾਂ ਗੱਲਾਂ ਸਾਰੀਆਂ ਭੁੱਲ ਚੁੱਕੇ ਹਾਂ ਜਾਂ ਦੇਖਣ ਨੂੰ ਵੀ ਨਹੀਂ ਮਿਲਦਾ ਪਰ ਜੇਕਰ ਗੱਲ ਕਰੀਏ ਮਸ਼ੀਨੀ ਯੁੱਗ ਦੀ ਤਾਂ ਮਸ਼ੀਨੀ ਯੁੱਗ ਇੰਨਾ ਅੱਗੇ ਵੱਧ ਚੁੱਕਿਆ ਹੈ ਕਿ ਸਮੇਂ ਥੋੜ੍ਹੇ ਸਮੇਂ ਬਾਅਦ ਜਦੋਂ ਕਿ ਡਿਜ਼ਾਇਨ ਚੇਂਜ ਹੋ ਜਾਂਦਾ ਹੈ ਜੇਕਰ ਅਸੀਂ ਕੱਪੜੇ ਦੀ ਗੱਲ ਕਰੀਏ ਤਾਂ ਕੱਪੜਿਆਂ ਦੇ ਡਿਜ਼ਾਇਨ ਜਾਂ ਜੁੱਤੀਆਂ ਦੇ ਡਿਜ਼ਾਇਨ ਜਾਂ ਕਢਾਈ ਦੀਆਂ ਚੀਜ਼ਾਂ ਦੇ ਡਿਜ਼ਾਇਨ ਸਾਰੇ ਹੀ ਜਲਦੀ ਤੋਂ ਜਲਦੀ ਬਦਲ ਜਾਂਦੇ ਹਨ ਇਹ ਸਾਡੇ ਪਿੰਡ ਦੇ ਇਸ ਸਾਡੇ ਸੱਭਿਆਚਾਰ ਨੂੰ ਪੁਰਾਣੇ ਸੱਭਿਆਚਾਰ ਦੀ ਗੱਲ ਕਰੀਏ ਤਾਂ ਉਹ ਸਮੇਂ ਇਹ ਕਲਾਕ੍ਰਿਤੀਆਂ ਦਾ ਬੋਲ ਬਾਲਾ ਬਹੁਤ ਦੇਰ ਤੱਕ ਚਲਦਾ ਰਹਿੰਦਾ ਸੀ ਧੰਨਵਾਦ